ਸਤਿ ਸ਼੍ਰੀ ਅਕਾਲ ਜੀ ਪੰਦਰਾਂ ਦਿਨ ਪਹਿਲਾਂ ਮੈਂ ਤੁਹਾਡੇ ਕੋਲ਼ ਇੱਕ ਫ਼ੋਨ ਔਡਰ ਕੀਤਾ ਸੀ ਜੋ ਕਿ ਜਦੋਂ ਮੈਨੂੰ ਮਿਲਿਆ ਤਾਂ ਉਸਦੀ ਪੈਕਿੰਗ ਬਹੁਤ ਹੀ ਘਟੀਆ ਸੀ ਅਤੇ ਜਦੋਂ ਉਸਨੂੰ ਮੈਂ ਖੋਲ੍ਹ ਕੇ ਦੇਖਿਆ ਤਾਂ ਫ਼ੋਨ ਦੀ ਹਾਲਤ ਬਹੁਤ ਹੀ ਬੁਰੀ ਸੀ ਅਤੇ ਜਦੋਂ ਮੈਂ ਹੱਥ ਫ਼ੋਨ 'ਚ ਫੜਿਆ ਤਾਂ ਉਹ ਹੱਥ 'ਚ ਫੜਿਆ ਹੋਇਆ ਫ਼ੋਨ ਬਿਲਕੁਲ ਵਧੀਆ ਨਹੀਂ ਲੱਗ ਰਿਹਾ ਸੀ ਉਸਦੀ ਕੈਮਰਾ ਕੋਐਲਿਟੀ ਹੈ ਜੋ ਉਹ ਬਹੁਤ ਹੀ ਜ਼ਿਆਦਾ ਘਟੀਆ ਹੈ ਅਤੇ ਮੇਰੇ ਘਰਦਿਆਂ 'ਚੋਂ ਕਿਸੇ ਵੀ ਮੈਂਬਰ ਨੂੰ ਉਹ ਫ਼ੋਨ ਨਹੀਂ ਵਧੀਆ ਲੱਗਿਆ ਅਤੇ ਜੋ ਉਸਦਾ ਚਾਰਜਰ ਹੈ ਉਹ ਤੁਸੀਂ ਕਿਹਾ ਸੀ ਵੀ ਇਹ ਚਾਰਜਰ ਤੀਹ ਮਿੰਟ 'ਚ ਸੱਠ ਸ ਸੱਠ ਪਰਸੈਂਟ ਫ਼ੋਨ ਚਾਰਜ ਕਰ ਸਕਦਾ ਹੈ ਪਰ ਉਹ ਤੀਹ ਮਿੰਟ 'ਚ ਚਾਲ਼ੀ ਪਰਸੈਂਟ ਬਹੁਤ ਹੀ ਮੁਸ਼ਕਿਲ ਨਾਲ਼ ਚਾਰਜ ਕਰਦਾ ਹੈ ਅਤੇ ਉਸਦੇ ਜੋ ਹੈੱਡਫੋਨ ਮਿਲੇ ਨੇ ਉਸ ਨਾਲ਼ ਉਹ ਵੀ ਹੈੱਡਫੋਨ ਬਹੁਤ ਹੀ ਘਟੀਆ ਕੁਆਲਿਟੀ ਦੇ ਨੇ ਜਦੋਂ ਹੈੱਡਫੋਨ ਕੰਨਾਂ 'ਚ ਲਾਉਂਦੇ ਹਾਂ ਤਾਂ ਆਵਾਜ਼ ਬਿਲਕੁਲ ਵੀ ਸਾਫ਼ ਨਹੀਂ ਆਉਂਦੀ ਹੈਗੀ ਅਤੇ ਸਾਨੂੰ ਇਹ ਫ਼ੋਨ ਬਿਲਕੁਲ ਵਧੀਆ ਨਹੀਂ ਲੱਗਿਆ ਅਤੇ ਸਾਡੇ ਘਰ 'ਚੋਂ ਕਿਸੇ ਇੱਕ ਮੈਂਬਰ ਨੇ ਇਹ ਫ਼ੋਨ ਔਡਰ ਕੀਤਾ ਹੋਇਆ ਸੀ ਜਿਸ ਦਾ ਔਡਰ ਮੈਂ ਕੈਂਸਲ ਕਰਵਾ ਦਿੱਤਾ ਹੈ